ਪੰਜਾਬ ਦੇ ਲੋਕ ਗੀਤ ਹੈ ਇੱਥੋਂ ਦੇ ਜਿਵੇਂ ਅੱਜ ਕੱਲ੍ਹ ਦੇ ਗ ਕਲਚਰ ਆ ਸਾਡੇ ਇਹ ਵੈਸਟਰਨ ਕਲਚਰ ਨੂੰ ਆਪਣਾ ਕੇ ਜਿਹੜੀ ਹੈਗੀ ਆ ਸਿਸਟਮ ਦੇ ਵਿੱਚ ਲੈ ਕੇ ਆ ਰਹੇ ਪੰਜਾਬ ਦੇ ਵਿੱਚ ਪੰਜਾਬ ਦਾ ਸ਼ੁਰੂ ਇਹ ਇਤਿਹਾਸ ਰਿਹਾ ਇੱਥੇ ਪੰਜਾਬ ਦੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮਾਂ ਦੇ ਵਿੱਚ ਅਕਸਰ ਹੀ ਪੰਜਾਬ ਦੇ ਲੋਕ ਪੰਜਾਬੀ ਬੋਲੀ ਪੰਜਾਬੀ ਮਾਂ ਬੋਲੀ ਪੰਜਾਬੀ ਦੇ ਗੀਤ ਇਹਨੂੰ ਕਰਦੇ ਸੀਗੇ ਜਿਵੇਂ ਦੂਲੇ ਦੇ ਜਿਹੜੇ ਦੂਲੇ ਦੇ ਵੇਹੜੇ 'ਤੇ ਆਪਣੀ ਸ਼ਗਨਾਂ ਦੇ ਗੀਤ ਤਾਂ ਬੀਬੀਆਂ ਅਕਸਰ ਗਾਉਂਦੀਆਂ ਪੰਜਾਬ ਦੇ ਵਿੱਚ ਗਾਉਣਾ ਜੋ ਕਿ ਜ਼ਰੂਰੀ ਵੀ ਹੈ ਕਿਉਂਕਿ ਇਸੇ ਨਾਲ ਪੰਜਾਬ ਦਾ ਇਤਿਹਾਸ ਆ ਜਿਹੜਾ ਪੰਜਾਬ ਦਾ ਕਲਚਰ ਹੈ ਸ ਸਰਗਦਾ ਉਹ ਅਤੇ ਇਹਦੇ ਨਾਲ ਹੀ ਜਿੱਥੋਂ ਤੱਕ ਪੰਜਾਬ ਦੀ ਗੱਲ ਹੈਗੀ ਪੰਜਾਬ ਸਾਡਾ ਇੱਕ ਅਜਿਹਾ ਸੂਬਾ ਹੈ ਜਿਹਨੇ ਅੱਜ ਤੱਕ ਈਨ ਨਹੀਂ ਮੰਨੀ ਪੰਜਾਬ ਦੀ ਉਦਾਹਰਨ ਬਾਹਰਲੇ ਮੁਲਕਾਂ ਤੱਕ ਕਿ ਪੂਰੇ ਵਰਲਡ ਦੇ ਵਿੱਚ ਸਭ ਤੋਂ ਵੱਧ ਮਸ਼ਹੂਰ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੀ ਖਾਸੀਅਤ ਹੈ ਇਹ ਲੋਕ ਪਹਿਲਾਂ ਪਹਿਲ ਨਹੀਂ ਕਰਦੇ ਅਤੇ ਬਾਅਦ ਵਿੱਚ ਆਪਣਾ ਅਸਲ ਦਾ ਰੂਪ ਦਿਖਾਉਂਦੇ ਹਨ ਕਿਉਂਕਿ ਸਾਡੀ ਪੰਜਾਬ ਦੀ ਧਰਤੀ ਸ਼ੁਰੂ ਤੋਂ ਹੀ ਗੁਰੂ ਪੀਰ ਫਕੀਰਾਂ ਦੀ ਰਹੀ ਹੈ ਅਤੇ ਗੁਰੂਆਂ ਨੇ ਸਾਡਿਆਂ ਨੇ ਇਹੀ ਸਿਖਾਇਆ ਵੀ ਪਹਿਲਾਂ ਵਾਧਾ ਨਹੀਂ ਕਰਨਾ ਅਤੇ ਦੂਜੇ 'ਚ ਬਖਸ਼ਣਾ ਨਹੀਂ ਹੈ